ਨਵਾਂਸ਼ਹਿਰ ਖੇਤਰ ਦੇ ਕੁਝ ਲੋਕ ਗੀਤ ਬਹੁਤ ਹੀ ਪ੍ਰਸਿੱਧ ਹਨ ਇਹ ਲੋਕ ਗੀਤ ਮਿੱਟੀ ਦਾ ਬਾਵਾ ਅਤੇ ਬਾਜਰੇ ਦਾ ਸਿੱਟਾ ਇਹ ਲੋਕ ਗੀਤ ਮੈਂ ਬਹੁ ਮੈਨੂੰ ਬਹੁਤ ਹੀ ਪਸੰਦ ਹੈ ਅਤੇ ਮੈਂ ਇਹਨਾਂ ਲੋਕਾਂ ਨੂੰ ਲੋਕ ਗੀਤਾਂ ਨੂੰ ਵਾਰ ਵਾਰ ਘਰ ਵੀ ਸੁਣਦੀ ਰਹਿੰਦੀ ਹਾਂ ਫ਼ੋਨ 'ਤੇ ਇਹ ਲੋਕ ਗੀਤ ਬਹੁਤ ਹੀ ਪ੍ਰਸਿੱਧ ਹਨ ਇਹ ਲੋਕ ਗੀਤ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਹਨ ਮਿੱਟੀ ਦਾ ਬਾਵਾ ਅਤੇ ਬਾਜਰੇ ਦਾ ਸਿੱਟਾ ਇਹ ਲੋਕ ਗੀਤ ਬਹੁਤ ਹੀ ਵਧੀਆ ਹਨ ਇਹ ਧਾਰਮਿਕ ਅਤੇ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਹਨ ਇਹ ਲੋਕ ਗੀਤ ਨਵਾਂਸ਼ਹਿਰ ਖੇਤਰ ਵਿੱਚ ਬਹੁਤ ਹੀ ਪ੍ਰਸਿੱਧ ਹਨ ਨਵਾਂਸ਼ਹਿਰ ਇਲਾਕਾ ਸਾਰਾ ਇਹਨਾਂ ਲੋਕ ਗੀ ਲੋਕ ਗੀਤਾਂ ਵੱਲ ਖਿੱਚਿਆ ਹੋਇਆ ਹੈ ਇਹ ਲੋਕ ਗੀਤ ਬਹੁਤ ਹੀ ਅਨੰਦਦਾਇਕ ਅਤੇ ਮਜ਼ੇਦਾਰ ਭਰਪੂਰ ਹਨ